ਡੇਂਗੂ ਬੁਖਾਰ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਜਿਹੜੀ ਆਲੇ ਦੁਆਲੇ ਦੀ ਸਫ਼ਾਈ ਹੈ ਉਸ ਦਾ ਧਿਆਨ ਰੱਖਣਾ ਚਾਹੀਦਾ ਨੰਬਰ ਦੋ ਸਾਨੂੰ ਆਪਣੀ ਜਿਹੜੀ ਰੋਜ਼ ਖਾਣ ਦੀ ਸਾਡੀ ਚੀਜ਼ਾਂ ਨੇਗੀਆਂ ਉਹ ਬਹੁਤ ਹੀ ਅੱਛੀਆਂ ਜਿਨ੍ਹਾਂ ਦੇ ਵਿੱਚ ਪ੍ਰੋਟੀਨ ਹੋਵੇ ਉਹ ਖਾਣੀਆਂ ਚਾਹੀਦੀਆਂ ਨੇ ਸਾਫ਼ ਸੁਥਰੀਆਂ ਹੋਣ ਤਾਜ਼ੀਆਂ ਹੋਣੀਆਂ ਚਾਹੀਦੀਆਂ ਨੇ ਸਾਨੂੰ ਖ਼ਰਾਬ ਸਬਜ਼ੀਆਂ ਜਾਂ ਫਰੂਟ ਨਹੀਂ ਖਰੀਦਣੇ ਚਾਹੀਦੇ ਹਰ ਰੋਜ਼ ਸਾਨੂੰ ਤਾਜ਼ੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਅਤੇ ਭੋਜਨ ਬਹੁਤ ਹੀ ਵਧੀਆ ਹੋਣਾ ਚਾਹੀਦਾ ਜਿਹਦੇ ਵਿੱਚ ਸਾਰੇ ਉਹ ਪਦਾਰਥ ਹਨ ਜਿਹੜੇ ਸਾਡੇ ਸਰੀਰ ਦੇ ਲਈ ਹਰ ਰੋਜ਼ ਲਈ ਲੋੜ ਹੁੰਦੀ ਹੈ ਡੇਂਗੂ ਬੁਖਾਰ ਤੋਂ ਬਚਣ ਲਈ ਸਾਨੂੰ ਨਾਰੀਅਲ ਦੇ ਪਾਣੀ ਦਾ ਜਿਹੜਾ ਉਹ ਜ਼ਿਆਦਾ ਪੀਣਾ ਚਾਹੀਦਾ ਲਿਕੁਡ ਚੀਜ਼ਾਂ ਨੇ ਜਿਹੜੀਆਂ ਪਾਣੀ ਨਾ ਜਿੱਦਾਂ ਦੁੱਧ ਹੋਇਆ ਜੂਸ ਵਗੈਰਾ ਹੋਇਆ ਉਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸਾਨੂੰ ਉਹ ਲੈਣੀਆਂ ਚਾਹੀਦੀਆਂ ਨੇ ਮੱਛਰ ਤੋਂ ਬਚਣ ਲਈ ਸਾਨੂੰ ਆਪਣੇ ਕਈ ਤਰ੍ਹਾਂ ਦੇ ਜਿੱਦਾਂ ਸਾਨੂੰ ਦੱਸੇ ਜਾਂਦੇ ਨੇ ਨੈਟ ਤੋਂ ਵੀ ਅਸੀਂ ਸਰਚ ਕਰ ਲੈਦੇ ਹਾਂ ਕੀ ਕੀ ਸਾਨੂੰ ਪ੍ਰੋਡਕਟ ਯੂਜ ਕਰਨੇ ਚਾਹੀਦੇ ਨੇ ਮੱਛਰ ਕਿ ਤੁਹਾਨੂੰ ਕੱਟ ਹੀ ਨਾ ਸਕੇ ਬਹੁਤ ਸਾਰੀਆਂ ਜਿੱਦਾਂ ਬ ਬਾਜ਼ਾਰ ਦੇ ਵਿੱਚੋਂ ਅਸੀਂ ਖ਼ਰੀਦ ਸਕਦੇ ਹਾਂ ਚੀਜ਼ਾਂ ਮਿਲਦੀਆਂ ਨੇ ਮੱਛਰਾਂ ਤੋਂ ਬਚਣ ਦੇ ਲਈ ਕਾਫ਼ੀ ਗੌਰਮੈਂਟ ਵੀ ਉਪਰਾਲੇ ਕਰ ਰਹੀ ਹੈ ਸਾਨੂੰ ਮੱਛਰਾਂ ਤੋਂ ਬਚਾਉਣ ਦੇ ਲਈ ਅਤੇ ਡੇਂਗੂ ਵਰ ਬੁਖਾਰ ਮਲੇਰੀਏ ਤੋਂ ਅਸੀਂ ਸਾਨੂੰ ਪਹਿਲਾਂ ਹੀ ਜਿਹੜਾ ਇਹ ਡੇਂਗੂ ਬੁਖਾਰ ਦੇ ਜਦੋਂ ਸਾਨੂੰ ਇਹ ਲੱਗਦਾ ਕਿ ਸਾਡੀ ਬੋਡੀ ਦਾ ਜਿਹੜਾ ਟੈਂਪਰੇਚਰ ਹੈ ਵਧਣ ਲੱਗ ਗਿਆ ਉਸ ਟਾਈਮ ਹੀ ਸਾਨੂੰ ਡੋਕਟਰ ਕੋਲ ਜਾਣਾ ਚਾਹੀਦਾ ਡੋਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਜਿਸ ਤਰ੍ਹਾਂ ਸਾਨੂੰ ਡੋਕਟਰ ਗਾਈਡ ਕਰਦੇ ਨੇ ਉਸ ਤਰ੍ਹਾਂ ਸਾਨੂੰ ਜਿਹੜਾ ਇਹ ਹਰ ਰੋਜ਼ ਆਪਣੇ ਧਿਆਨ ਨਾਲ ਆਪਣੀ ਦਵਾਈ ਲੈਣੀ ਚਾਹੀਦੀ ਹੈ ਅਤੇ ਨਾਲ ਨਾਲ ਹੀ ਆਪਣੀ ਖੁਰਾਕ ਹੈ ਜਿਹੜੀ ਉਹ ਟਾਈਮ ਟੂ ਟਾਈਮ ਲੈ ਖਾਣੀ ਚਾਹੀਦੀ ਹੈ ਅਤੇ ਬਹੁਤ ਹੀ ਵਧੀਆ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਸਾਡਾ ਸਰੀਰ ਹੈ ਡੇਂਗੂ ਜਾਂ ਮਲੇਰੀਏ ਤੋਂ ਜਲਦੀ ਆਪਣੀ ਈ ਰਿਕਵਰੀ ਕਰ ਸਕੇ ਥੈਂਕ ਯੂ ਧੰਨਵਾਦ